ਹਾਂਜੀ ਮੈਨੂੰ ਪਸ ਬਹੁਤ ਸਾਰੀਆਂ ਫਿਲਮਾਂ ਪਸੰਦ ਹਨ ਜਿਵੇਂ ਕਿ ਐਮੀ ਵਿਰਕ ਦੀ ਸੁਪਨਾ ਸੁਪਨਾ ਦੇ ਵਿੱਚ ਇੱਕ ਲਵ ਸਟੌਰੀ ਹੈਗੀ ਆ ਅਤੇ ਉਸ ਵਿੱਚ ਐਮੀ ਵਿਰਕ ਹੁੰਦਾ ਹੈ ਅਤੇ ਤਾਨੀਆ ਹੁੰਦੀ ਹੈ ਐਮੀ ਵਿਰਕ ਇੱਕ ਜੱਟ ਜਾਤੀ ਤੋਂ ਬਿਲੌਗ ਕਰਦਾ ਹੈ ਅਤੇ ਤਾਨੀਆ ਨੀਵੀਂ ਜਾਤੀ ਤੋਂ ਬਿਲੌਗ ਕਰਦੀ ਹੈ ਜੋ ਕਿ ਉਹਨਾਂ ਦੇ ਪੇਂਰਟਸ ਜਿਹੜੇ ਹੁੰਦੇ ਹਨ ਉਸ ਮੈਰਿਜ਼ ਤੋਂ ਖਿਲਾਫ਼ ਹੁੰਦੇ ਹਨ ਪ੍ਰੰ ਪਰ ਐਮੀ ਵਿਰਕ ਹਾਰ ਨਹੀਂ ਮੰਨਦਾ ਉਹ ਕੁਛ ਬਣਕੇ ਫਿਰ ਆਉਂਦਾ ਹੈ ਫਿਰ ਉਸ ਤੋਂ ਬਾਅਦ ਉਹ ਕੁੜੀ ਨਾਲ ਕੁੜੀ ਲਈ ਕਾਫੀ ਕੁਛ ਕਰਦਾ ਹੈ ਅਤੇ ਬਹੁਤ ਹੀ ਸਟਰੱਗਲ਼ ਕੱਟਣ ਤੋਂ ਬਾਅਦ ਉਹ ਉਹ ਆਰ ਆਰਮੀਂ ਆਫਿਸਰ ਬਣਕੇ ਆਉਂਦਾ ਹੈ ਅਤੇ ਕੁੜੀ ਨੂੰ ਕੁੜੀ ਦੇ ਨਾਲ ਵਿਆਹ ਕਰਕੇ ਉਸਨੂੰ ਲੈ ਕੇ ਜਾਂਦਾ ਹੈ